ਮੈਨੂੰ ਜੋ ਨਾ ਰਾਜਨੀਤੀ ਰਿਗਾਰਡਿੰਗ ਜੋ ਬੁੱਕਸ ਨੇ ਜੋ ਪੋਲੀਟੀਕਲ ਦੀਆਂ ਬੁੱਕਸ ਨੇ ਉਹ ਜਾਂ ਪੋਲੀਟੀਕਲ ਸਬਜੈਕਟ ਹੀ ਮੈਨੂੰ ਚੰਗਾ ਨਹੀਂ ਲੱਗਦਾ ਸੀਗਾ ਅਤੇ ਇੱਕ ਮਨ 'ਚ ਪਰਸੈਪਸ਼ਨ ਬਣੀ ਹੋਈ ਸੀ ਵੀ ਨਹੀਂ ਸਬਜੈਕਟ ਨਹੀਂ ਚੰਗਾ ਮੈਂ ਬੜਾ ਡਰਦਾ ਹੁੰਦਾ ਸੀ ਛੋਟੇ ਹੁੰਦੇ ਤੋਂ ਲੈ ਕੇ ਸਕੂਲਿੰਗ ਤੋਂ ਲੈ ਕੇ ਮਾਸਟਰ ਵੀ ਕਲੀਅਰ ਕਰ ਗਿਆ ਮੈਂ ਜੌਗਰਾਫ਼ੀ ਵੀ ਕਰ ਪੜ੍ਹ ਲਈ ਮਾਸਟਰ ਲੈਵਲ ਤੱਕ ਪਰ ਬਾਅਦ ਉਸ ਸਮੇਂ ਤੱਕ ਮੇਰਾ ਕੋਈ ਇੰਟਰਸਟ ਨਹੀਂ ਬਣਿਆ ਜੌਗ ਪੋਲੀਟੀਕਲ ਦੇ ਵਿੱਚ ਕਈਆਂ ਨੇ ਮੈਨੂੰ ਕਿਹਾ ਵੀ ਬੜਾ ਅੱਛਾ ਸਬਜੈਕਟ ਹੈ ਕੁਛ ਪੜ੍ਹ ਇਹਦੇ ਬਾਰੇ ਨਾ ਮੈਨੂੰ ਪੋਲੀਟੀਕਲ ਬਾਰੇ ਕੁਛ ਪਤਾ ਸੀ ਨਾ ਇੰਡੀਅਨ ਪੋਲੀਟੀਕਲ ਸਿਸਟਮ ਬਾਰੇ ਕੁਛ ਪਤਾ ਸੀ ਨਾ ਪੰਜਾਬ ਪੋਲੀਟੀਕਲ ਸਿਸਟਮ ਬਾਰੇ ਕੁਛ ਪਤਾ ਸੀ ਪਰ ਬਾਅਦ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਮੇਰੇ ਇੱਕ ਫਰੈਂਡ ਨੇ ਮੈਨੂੰ ਨਾ ਪੋਲੀਟੀਕਲ ਦੀ ਇੱਕ ਇੰਡੀਅਨ ਪੋਲੀਟੀਕਲ ਸਿਸਟਮ ਦੀ ਇੱਕ ਬੁੱਕ ਜਿਹੜੀ ਹੈਗੀ ਆ ਉਹ ਗਿਫ਼ਟ ਕੀਤੀ ਤਾਂ ਜਦੋਂ ਬੁੱਕ ਗਿਫ਼ਟ ਕੀਤੀ ਮੈਂ ਉਸ ਸਮੇਂ ਬੁੱਕ ਲੈ ਕੇ ਆਪਣੀ ਜਿਹੜੀ ਹੈ ਲਾਈਬ੍ਰੇਰੀ ਆਪਣੇ ਘਰ ਰੱਖ ਲਈ ਪਰ ਫਿਰ ਜਦੋਂ ਛੁੱਟੀਆਂ ਹੋਈਆਂ ਜੂਨ ਦੀਆਂ ਛੁੱਟੀਆਂ ਹਾਂ ਛੁੱਟੀਆਂ ਦੇ ਵਿੱਚ ਜਦੋਂ ਮੈਂ ਫ੍ਰੀ ਸੀ ਬਿਲਕੁਲ ਤਾਂ ਉਸ ਸਮੇਂ 'ਚ ਮੈਂ ਦੇਖਾਂ ਜੋ ਬੁੱਕ ਦੇ ਵਿੱਚ ਹੈ ਕੀ ਮੈਂ ਬੁੱਕ ਪੜ੍ਹਨ ਲੱਗਾ ਅਤੇ ਜਦੋਂ ਮੈਂ ਉਹ ਬੁੱਕ ਪੜ੍ਹਨ ਲੱਗਾ ਤਾਂ ਸ਼ੁਰੂਆਤ ਦੇ ਵਿੱਚ ਮੈਨੂੰ ਬੁੱਕ ਬੋਰਿੰਗ ਲੱਗੀ ਜਿਵੇਂ ਮੇਰਾ ਸ਼ੁਰੂ ਤੋਂ ਹੀ ਜਿਹੜਾ ਇੱਕ ਪਰਸੈਪਸ਼ਨ ਬਣਿਆ ਆ ਰਿਹਾ ਇਸ ਲਈ ਮੈਨੂੰ ਬੁੱਕ ਬੜੀ ਬੋਰਿੰਗ ਲੱਗੀ ਪਰ ਬਾਅਦ ਦੇ ਵਿੱਚ ਜਦੋਂ ਮੈਂ ਹੌਲੀ ਹੌਲੀ ਬੁੱਕ ਨੂੰ ਪੜ੍ਹਨ ਲੱਗਿਆ ਤਾਂ ਮੈਨੂੰ ਇੰਟਰਸਟ ਆਉਣ ਲੱਗਿਆ ਕਿਉਂਕਿ ਅੱਗੇ ਜਾ ਕੇ ਉਹ ਜਿਹੜੀ ਬੁੱਕ ਹੈ ਪੋਲੀਟੀਕਲ ਸਿਸਟਮ ਹੈ ਉਹ ਮੇਰੇ ਸਬਜੈਕਟ ਜੋਗਰਾਫ਼ੀ ਨਾਲ ਜਿਹੜਾ ਹੈ ਕੋਲੇਟ ਹੋਣ ਲੱਗ ਗਿਆ ਕੋਲੇਟ ਹੋਣ ਲੱਗ ਗਿਆ ਫਿਰ ਮੈਂ ਆਖਿਆ ਸਮਝਣ ਲੱਗ ਗਿਆ ਵੀ ਹਾਂ ਜੋਗਰਾਫ਼ੀ ਵਿੱਚ ਆਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਜਿਹੜੀਆਂ ਬੌਂਡਰੀਜ਼ ਨੇ ਉਹ ਕਿਸ ਤਰੀਕੇ ਨਾਲ ਉਹ ਪੋਲੀਟੀਕਲ ਸਿਸਟਮ ਨਾਲ ਕੋਲੇਟ ਨੇ ਤਾਂ ਉਹ ਚੀਜ਼ਾਂ ਸਮਝ ਸਕਦੇ ਫਿਰ ਸਾਰੀ ਬੁੱਕ ਜਦੋਂ ਪੜ੍ਹੀ ਤਾਂ ਮੇਰਾ ਪੋਲੀਟੀਕਲ ਦੇ ਵਿੱਚ ਬੜਾ ਹੀ ਅੱਛਾ ਇੰਟਰਸਟ ਕ੍ਰੀਏਟ ਹੋਇਆ ਮੈਂ ਜੋ ਪੋਲੀਟੀਕਲ ਹੈ ਉਹ ਸਾਰੀ ਇੰਡੀਅਨ ਪੋਲੀਟੀ ਜਿਹੜੀ ਉਹ ਪੜ੍ਹੀ ਉਸ ਤੋਂ ਇਲਾਵਾ ਕੁਛ ਹੋਰ ਬੁਕਸ ਹੈ ਜਿਵੇਂ ਇੰਡੀਅਨ ਪੋਲੀਟੀ ਬਾਰੇ ਲਕਸ਼ਮੀ ਕਾਂਤ ਹੈ

ਵੱਖੋ ਵੱਖਰੇ ਸਬਜੈਕਟਸ ਨੂੰ ਜਿਹੜੀ ਹੈਗੀ ਹੈ ਤੁਸੀਂ ਉਹਨੂੰ ਰੀਡ ਕਰੋ ਪੜ੍ਹੋ ਤਾਂ ਜੋ ਤੁਹਾਨੂੰ ਇੱਕ ਆਲ ਰਾਊਂਡ ਇੱਕ ਜਿਹੜੀ ਹੈਗੀ ਆ ਨੌਲੇਜ ਉਹ ਗੇਨ ਹੋਵੇ ਤਾਂ ਉਸ ਪਰਪਜ਼ ਦੇ ਲਈ ਜਿਹੜੀ ਹੈਗੀ ਆ ਮੈਂ ਪੋਲੀਟੀਕਲ ਪੜ੍ਹੀ ਇਸ ਤੋਂ ਬਾਅਦ ਮੈਂ ਪੋਲੀਟੀਕਲ ਨੇ ਮੈਨੂੰ ਹੋਰ ਸਬਜੈਕਟ ਨਹੀਂ ਚੰਗੇ ਲੱਗਦੇ ਮੈਂ ਉਹ ਤੋਂ ਬਾਅਦ ਉਹ ਵੀ ਪੜ੍ਹਨ ਲੱਗਿਆ ਸਿਰਫ਼ ਇਹ ਬਦੌਲਤ ਹੋਇਆ ਮੇਰੇ ਉਸ ਦੋਸਤ ਕਰਕੇ ਜਿਹਨੇ ਮੈਨੂੰ ਇੱਕ ਇਹੋ ਜਿਹੇ ਸਬਜੈਕਟ ਦੀ ਬੁੱਕ ਜਿਹੜੀ ਹੈਗੀ ਹੈ ਗਿਫ਼ਟ ਕੀਤੀ ਜਿਹੜਾ ਮੈਨੂੰ ਨਹੀਂ ਚੰਗਾ ਲੱਗਦਾ ਸੀ ਅਤੇ ਉਹ ਮੇਰਾ ਇੱਕ ਇੰਟਰਸਟ ਜਿਹੜਾ ਹੈ ਉਹ ਕ੍ਰੀਏਟ ਹੋਇਆ ਅਤੇ ਮੇਰਾ ਸੁਭਾਅ ਸੀ ਮੇਰਾ ਮਨ ਸੀ ਉਹ ਬੁੱਕ ਨੇ ਸਾਰਾ ਹੀ ਨੇਚਰ ਮੇਰਾ ਚੇਂਜ ਕਰਤਾ